ਮੈਨੂੰ ਕਿਤਾਬਾਂ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ ਖਾਸ ਕਰਕੇ ਮੈਨੂੰ ਸੱਚੀਆਂ ਘਟਨਾਵਾਂ ਜਿਵੇਂ ਕਿ ਸਾਡਾ ਪੰਜਾਬ ਸਾਡਾ ਪੰਜਾਬ ਕਿਤਾਬ ਜਦੋਂ ਮੈਂ ਪੜ੍ਹੀ ਇਹਦੇ ਵਿੱਚ ਮੈਨੂੰ ਜਦੋਂ ਖਾਲਸਾ ਪੰਥ ਦੀ ਸਾਜਨਾ ਦਾ ਦ੍ਰਿਸ਼ ਸੀਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਤੇਰਾਂ ਅਪ੍ਰੈਲ ਉੱਨੀ ਸੌ ਸੋਲ੍ਹਾਂ ਸੌ ਨੜਿਨਵੇਂ ਨੂੰ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਹ ਦ੍ਰਿਸ਼ ਮੇਰੀਆਂ ਅੱਖਾਂ ਦੇ ਮੂਹਰੇ ਘੁੰਮਿਆ ਤਾਂ ਉਹਨੂੰ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਜਦੋਂ ਤੇਰਾਂ ਅਪ੍ਰੈਲ ਉੱਨੀ ਸੋਲ੍ਹਾਂ ਸੌ ਨੜਿਨਵੇਂ ਨੂੰ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾ ਖਾਲਸਾ ਪੰਥ ਦੀ ਸਿਰਜਨਾ ਕੀਤੀ ਤਾਂ ਉਹਨਾਂ ਨੇ ਨੰਗੀ ਤਲਵਾਰ ਲੈ ਕੇ ਪਹਿਲਾਂ ਇੱਕ ਸਿਰ ਦੀ ਮੰਗ ਕੀਤੀ ਤਾਂ ਇੱਕ ਸਿਰ ਇੱਕ ਸਿੰਘ ਭਾਈ ਦਇਆ ਸਿੰਘ ਉੱਠ ਕੇ ਉਹਨਾਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਜਦੋਂ ਗੁਰੂ ਜੀ ਉਹਨੂੰ ਤੰਬੂ ਦੇ ਤੰਬੂ ਅੰਦਰ ਲੈ ਗਏ ਤਾਂ ਜਦੋਂ ਬਾਹਰ ਲੈ ਕੇ ਆਏ ਤਾਂ ਉਹਨਾਂਂ ਦੀ ਤਲਵਾਰ ਲਾਲ ਖੂਨ ਨਾਲ ਲਥਪਥ ਸੀ ਅਤੇ ਗੁਰੂ ਜੀ ਨੇ ਇੱਦਾਂ ਵਾਰੀ ਵਾਰੀ ਕਰਕੇ ਚਾਰ ਹੋਰ ਸਿਰਾਂ ਦੀ ਮੰਗ ਕੀਤੀ ਅਤੇ ਪ ਅਤੇ ਹੋਰ ਚਾਰ ਸਿੱਖਾਂ ਨੇ ਉੱਠ ਕੇ ਗੁਰੂ ਜੀ ਦੀ ਇਹਨਾਂ ਨੂੰ ਮੰਗ ਨੂੰ ਪੂਰਾ ਕੀਤਾ ਅਤੇ ਗੁਰੂ ਜੀ ਨੇ ਉਹਨਾਂ ਨੂੰ ਉੱਥੇ ਅੰਮ੍ਰਿਤ ਛਕਾਇਆ ਅਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਖੁਦ ਉਹਨਾਂ ਤੋਂ ਅੰਮ੍ਰਿਤ ਛਕਿਆ ਅਤੇ ਜਿਹੜੇ ਜਿੱਦਾਂ ਹੁਣ ਸਾਡੇ ਸਿੱਖ ਇਤਿਹਾਸ ਵਿੱਚ ਮਾਰਚ ਮਹੀਨੇ ਹੋਲਾ ਮਹੱਲਾ ਮਨਾਇਆ ਜਾਂਦਾ ਹੈਗਾ ਹੈ ਹੋਲੇ ਮਹੱਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਜੌਹਰ ਦੇਖਦੇ ਉਹਨਾਂ ਦਾ ਸ਼ਕਤੀ ਪ੍ਰਦਸ਼ਨ ਦੇਖਦੇ ਹੈ ਜੀ